ਅੰਤਰ ਭਾਈਚਾਰਕ ਲੜਾਈਆਂ ਸੰਬੰਧੀ ਮੈਂ ਸਕੂਲੀ ਪੜ੍ਹਾਈ ਦੌਰਾਨ ਕਿਤਾਬਾਂ ਵਿੱਚ ਪੜ੍ਹਿਆ ਹੈ ਜੇਕਰ ਮੇਰੇ ਸ਼ਹਿਰ ਕਪੂਰਥਲੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਜਿਸ ਵਿੱਚ ਮੈਂ ਕੋਈ ਲੰਮਾ ਇਤਿਹਾਸ ਦੱਸ ਸਕਾਂ ਇਸ ਲਈ ਅਜਿਹੀ ਕਿਸੇ ਘਟਨਾ ਦਾ ਮੇਰੇ ਜ਼ਿੰਦਗੀ ਮੇਰੀ ਨਿੱਜੀ ਜ਼ਿੰਦਗੀ ਵਿੱਚ ਕੋਈ ਪ੍ਰਭਾਵ ਨਹੀਂ ਪਿਆ ਇਸ ਤੋਂ ਇਲਾਵਾ ਪਿੰਡਾਂ ਵਿੱਚ ਆਪਸੀ ਰੰਜਿਸ਼ ਜਾਂ ਪਾਰਟੀਬਾਜ਼ੀ ਕਾਰਨ ਕਈ ਛੋਟੀਆਂ ਮੋਟੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸ ਕਾਰਨ ਕੁਝ ਸਮੇਂ ਲਈ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ